ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਸਾਰਿਆਂ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਅਤੇ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਪਿਆਰਾ ਜਿਹੜਾ ਪੜਾਅ ਹੁੰਦਾ ਉਹ ਬਚਪਨ ਹੁੰਦਾ ਏ ਅਤੇ ਹਰੇਕ ਦੀਆਂ ਬਚਪਨ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ ਜਿਹੜੀਆਂ ਕਿ ਬੰਦੇ ਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੀਆਂ ਹਨ ਅਤੇ ਮੇਰੀਆਂ ਵੀ ਬਚਪਨ ਦੀਆਂ ਕੁਝ ਇੱਦਾਂ ਦੀਆਂ ਹੀ ਯਾਦਾਂ ਹਨ ਜਿਹੜੀਆਂ ਕਿ ਬਹੁਤ ਜ਼ਿਆਦਾ ਮੇਰੇ ਦਿਲ ਨੂੰ ਸਕੂਨ ਦਿੰਦੀਆਂ ਹਨ ਜਦੋਂ ਮੈਂ ਉਹਨਾਂ ਨੂੰ ਯਾਦ ਕਰਦੀ ਹਾਂ ਜਿਵੇਂ ਕਿ ਦੁਪਹਿਰ ਨੂੰ ਲਾਈਟ ਨਹੀਂ ਹੁੰਦੀ ਸੀਗੀ ਅਤੇ ਸਾਰੇ ਬੱਚੇ ਮਿਲਕੇ ਗਲੀ 'ਚ ਖੇਡਦੇ ਸੀਗੇ ਬਾਂਦਰ ਕਿੱਲਾ ਅਤੇ ਜਦੋਂ ਖੇਡਦੇ ਸੀਗੇ ਤਾਂ ਦਿਲ ਨੂੰ ਇੱਕ ਅਜਿਹਾ ਸਕੂਨ ਮਿਲਦਾ ਸੀਗਾ ਕਿ ਜਿਹੜਾ ਆਪਾਂ ਲਫ਼ਜਾਂ 'ਚ ਬਿਆਨ ਨਹੀਂ ਕਰ ਸਕਦੇ ਅਤੇ ਉਸਤੋਂ ਇਲਾਵਾ ਪੇੜਾਂ 'ਤੇ ਚੜ੍ਹਕੇ ਜਾਮਣਾਂ ਤੋੜਨੀਆਂ ਫ਼ਲ ਤੋੜਨੇ ਅਤੇ ਜਿਹਨਾਂ ਦੇ ਫ਼ਲ ਹੁੰਦੇ ਸੀ ਉਹ ਬਜ਼ੁਰਗ ਸਾਡੇ ਪਿੱਛੇ ਡੰਡਾ ਲੈ ਕੇ ਪੈ ਜਾਂਦੇ ਸੀਗੇ ਅਤੇ ਅਸੀਂ ਅੱਗੇ ਅੱਗੇ ਭੱਜਦੇ ਸੀ ਇਹ ਸਾਰੀਆਂ ਗੱਲਾਂ ਮੈਨੂੰ ਬਹੁਤ ਜ਼ਿਆਦਾ ਯਾਦ ਆਉਂਦੀਆਂ ਹਨ ਅਤੇ ਇੱਕ ਦਿਲ ਨੂੰ ਵੱਖਰਾ ਹੀ ਸਕੂਨ ਦਿੰਦੀਆਂ ਹਨ ਇਸ ਤੋਂ ਇਲਾਵਾ ਰਾਤ ਨੂੰ ਜਦੋਂ ਲਾਈਟ ਚਲੇ ਜਾਂਦੀ ਸੀ ਤਾਂ ਦਾਦੀ ਮਾਂ ਤੋਂ ਬਾਤਾਂ ਸੁਣਨੀਆਂ ਬਾਤਾਂ ਸੁਣਦੇ ਸੁਣਦੇ ਅਸੀਂ ਸੌਂ ਜਾਣਾ ਇਹ ਸਾਰੀਆਂ ਗੱਲਾਂ ਨੂੰ ਅਸੀਂ ਮਿਸ ਵੀ ਕਰਦੇ ਹਾਂ ਯਾਦ ਵੀ ਕਰਦੇ ਹਾਂ ਕਿ ਇਹ ਪਲ ਹੁਣ ਦੁਬਾਰਾ ਜ਼ਿੰਦਗੀ 'ਚ ਵਾਪਿਸ ਨਹੀਂ ਆਉਣੇ ਹੈਗੇ